ਤੁਹਾਨੂੰ ਬਾਈਕਿੰਗ ਸ਼ੁਰੂ ਕਰਨ ਲਈ ਕਿਸ ਚੀਜ਼ ਨੇ ਪ੍ਰੇਰਿਤ ਕੀਤਾ ਸਾਨੂੰ ਬਾਈਕਿੰਗ ਸ਼ੁਰੂ ਕਰਨ ਲਈ ਆਸ ਪਾਸ ਦੇ ਮਾਹੌਲ ਨੇ ਪ੍ਰੇਰਿਤ ਕੀਤਾ ਜਦੋਂ ਕਿਤੇ ਜਾਣਾ ਸੀ ਉਹਦੇ ਵਿੱਚ ਬਹੁਤ ਤੁਰ ਕੇ ਪੈਦਲ ਜਾਣ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ ਪਰ ਜਦੋਂ ਜਦੋਂ ਦਾ ਜਦੋਂ ਦੀ ਬਾਈਕਿੰਗ ਕਰਨੀ ਸ਼ੁਰੂ ਕੀਤੀ ਆ ਕੁਝ ਕੁ ਸੈਕਿੰਡਾਂ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਚਲੇ ਚਲੇ ਚਲੇ ਜਾਂਦੀ ਹਾਂ ਬਾਈਕਿੰਗ ਬਾਈਕਿੰਗ ਨੇ ਸਾਡੇ ਜੀਵਨ ਨੂੰ ਬਹੁਤ ਜ਼ਿਆਦਾ ਸੁਖਾਲਾ ਕਰ ਦਿੱਤਾ ਹੈ ਇਸ ਨਾਲ ਅਸੀਂ ਇੱਕ ਸਮੇਂ ਕੁਝ ਕ ਸਮੇਂ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾ ਕੇ ਜਾ ਕੇ ਆਪਣੇ ਕੰਮ ਨੂੰ ਛੇਤੀ ਨਿਪਟਾ ਸਕਦੇ ਹਾਂ ਅਤੇ ਸਾਲਾਂ ਦੌਰਾਨ ਇਸ ਲਈ ਸਾਡਾ ਜਨੂੰਨ ਇਸ ਕਰਕੇ ਵਿਕਸਿਤ ਹੋਇਆ ਹੈ ਕਿਉਂਕਿ ਉਸਨੇ ਸਾਡੇ ਜੀਵਨ ਨੂੰ ਸੁਖਾਲਾ ਕਰ ਦਿੱਤਾ ਅਤੇ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾ ਸਕਦੇ ਹਾਂ ਜਾ ਸਕਦੇ ਹਾਂ ਇਸ ਨਾਲ ਸਾਡੇ ਕੰਮਾਂ ਕਾਰਾਂ ਵਿੱਚ ਸਾਨੂੰ ਬਹੁ ਬਹੁਤ ਜ਼ਿਆਦਾ ਆਸਾਨੀ ਪ੍ਰਾਪਤ ਹੁੰਦੀ ਹੈ ਇਸ ਲਈ ਸਾਡੇ ਜੀਵਨ ਨੂੰ ਬਾਈਕਿੰਗ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੁਖਾਲਾ ਕੀਤਾ ਹੈ ਅਤੇ ਇਸ ਨੇ ਸਾਡੇ ਜਨੂੰਨ ਨੂੰ ਵੀ ਇਸ ਤਰ੍ਹਾਂ ਹੀ ਵਿਕਸਿਤ ਕੀਤਾ ਹੈ ਬਾਈਕਿੰਗ ਬਾਈਕਿੰਗ ਸਾਡੇ ਜੀਵਨ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਨਿਭਾ ਰਿਹਾ ਹੈ ਜਿਸ ਦੌਰਾਨ ਜਿਸ ਦੌਰਾਨ ਅਸੀਂ ਆਪਣੇ ਕੰਮਾਂ ਨੂੰ ਛੇਤੀ ਤੋਂ ਛੇਤੀ ਛੇਤੀ ਨਿਪਟਾ ਲੈਂਦੇ ਹਾਂ ਅਤੇ ਟਾਈਮ ਸਿਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਚਲੇ ਜਾਂਦੇ ਹਾਂ ਇਸ ਕਰਕੇ ਬਾਈਕਿੰਗ ਇੱਕ ਐਸਾ ਸਾ ਐ ਇਹੋ ਜਿਹਾ ਸਾਧਨ ਹੈ ਜਿਸ ਨਾਲ ਅਸੀਂ ਆਪਣੇ ਕੰਮਾਂ ਕਾਰਾਂ ਅਤੇ ਛੇਤੀ ਪਹੁੰਚ ਸਕਦੇ ਹਾਂ ਅਤੇ ਜਲਦੀ ਤੋਂ ਜਲਦੀ ਵਾਪਿਸ ਆ ਸਕਦੇ ਹਾਂ ਇਸ ਇਸ ਵਿੱਚ ਸਾਨੂੰ ਇਹ ਕਰਨ ਨਾਲ ਸਾਡਾ ਬਹੁਤ ਘੱਟ ਸਮਾਂ ਲੱਗਦਾ ਹੈ ਇਸ ਕਰਕੇ ਸਾਨੂੰ ਬਾਈਕਿੰਗ ਨੇ ਪ੍ਰੇਰਿਤ ਕੀਤਾ ਹੈ ਅਤੇ ਇਸ ਨੇ ਸਾਡੇ ਜਨੂੰਨ ਨੂੰ ਵੀ ਵਿਕਸਿਤ ਕੀਤਾ ਹੈ